ਅੱਜ ਭਾਰਤ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਪਿੰਡਾਂ ਦੇ ਬਿਮਾਰ ਲੋਕਾਂ ਨੂੰ ਦੂਰ ਸ਼ਹਿਰਾਂ ਵੱਲ ਹਸਪਤਾਲ ਜਾਣਾ ਪੈ ਰਿਹਾ ਹੈ ਸਰਕਾਰ ਨੂੰ ਚਾਹੀਦਾ ਕਿ ਪਿੰਡਾਂ ਵਿੱਚ ਹੀ ਹਸਪਤਾਲ ਬਣਾਏ ਜਾਣ ਮਸ਼ੀਨਾਂ ਰੱਖੀਆਂ ਜਾਣ ਤਾਂ ਜੋ ਲੋਕ ਸ਼ਹਿਰਾਂ ਵਿੱਚ ਨਾ ਖਰਾਬ ਹੋਣ ਨਾ ਖਰਾਬ ਹੋਣ ਅਤੇ ਉੱਧਰੋਂ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਵਿੱਚ ਵੀ ਸਕ ਪਿੰਡ ਦੇ ਸਕੂਲਾਂ ਵਿੱਚ ਪੜ੍ਹਾਈ ਨਹੀਂ ਰਹੀ ਇਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਪੜ੍ਹਾਉਣ ਲਈ ਭੇਜਦੇ ਹਨ ਜਿਸ ਕਾਰਨ ਮਹਿੰਗਾਈ ਦਾ ਜਿਸ ਕਾਰਨ ਮਹਿੰਗਾਈ ਦਾ ਰੁਜ਼ਗਾਰ ਵੱਧਦਾ ਜਾ ਰਿਹਾ ਇਸ ਲਈ ਸਿਖਲਾਈ ਵ ਅ ਲਈ ਵਧੀਆ ਸਕੂਲ ਖੋਲ੍ਹੇ ਜਾਣ ਤਾਂ ਜੋ ਬੱਚੇ ਪਿੰਡ ਵਿੱਚ ਹੀ ਪੜ੍ਹ ਸਕਣ ਅਤੇ ਪੜ੍ਹ ਸਕਣ ਅਤੇ ਦੂਰ ਨਾ ਜਾਣਾ ਪਵੇ ਜਿਸ ਕਾਰਨ ਬੱਸਾਂ ਦੇ ਕਿਰਾਏ ਵੀ ਦਿੱਤੇ ਜਾਂਦੇ ਹਨ ਦਿੱਤੇ ਜਾਂਦੇ ਹਨ ਸਰਕਾਰ ਨੂੰ ਚਾਹੀਦਾ ਕਿ ਪਿੰਡ ਵਿੱਚ ਹੀ ਸਕੂਲ ਖੋਲ੍ਹੇ ਜਾਣ